ਪਟਿਆਲੇ ਜ਼ਿਲ੍ਹੇ ਵਿੱਚ ਰੁਜ਼ਗਾਰ ਅਤੇ ਰੋਜ਼ੀ ਰੋਟੀ ਦੇ ਮੁੱਖ ਸਰੋਤ ਖੇਤੀਬਾੜੀ ਛੋਟੇ ਛੋਟੇ ਕਾਰੋਬਾਰ ਜਿਸ ਵਿੱਚ ਰੇਹੜੀ ਲਾਉਣਾ ਛੋਟੀਆਂ ਦੁਕਾਨਾਂ ਖੋਲ੍ਹਣੀਆਂ ਪਿੰਡਾਂ ਵਿੱਚ ਫੇਰੀਆਂ ਲਾਉਣਾ ਆਦਿ ਸ਼ਾਮਿਲ ਹਨ ਹਾਂ ਲੋਕ ਸਰਕਾਰੀ ਨੌਕਰੀਆਂ ਕਰਨ ਨੂੰ ਤਰਜੀਹ ਦਿੰਦੇ ਹਨ ਪਰ ਜੇ ਕਿਸੇ ਨੂੰ ਸਰਕਾਰੀ ਨੌਕਰੀ ਨਾ ਮਿਲੇ ਉਹ ਨਿਜੀ ਕਾਰੋਬਾਰ ਕਰਨ ਅਤੇ ਨਿਜੀ ਨੌਕਰੀਆਂ ਕਰਨ ਵਿੱਚ ਵੀ ਵਿਸ਼ਵਾਸ ਰੱਖਦੇ ਹਨ ਅੱਜ ਬੇਰੁਜ਼ਗਾਰੀ ਬਹੁਤ ਜ਼ਿਆਦਾ ਫੈਲ ਰਹੀ ਹੈ ਸਭ ਲੋਕ ਵਧੀਆ ਵਾਇਟ ਕਾਲਰ ਨੌਕਰੀਆਂ ਚਾਹੁੰਦੇ ਹਨ ਜੋ ਹਰ ਕਿਸੇ ਲਈ ਮੁਮਕਿਨ ਨਹੀਂ ਇਸੇ ਵਜ੍ਹਾ ਕਰਕੇ ਨੌਕਰੀਆਂ ਦੀ ਘਾਟ ਲੱਗਦੀ ਹੈ ਜਦੋਂ ਕਿ ਅਸਲ ਵਿੱਚ ਹਕੀਕਤ ਇਹ ਹੈ ਕਿ ਅੱਜ ਅਸੀਂ ਵੀ ਸਾਰੀ ਤਰ੍ਹਾਂ ਦੀਆਂ ਨੌਕਰੀਆਂ ਦੇ ਕਾਬਲ ਨਹੀਂ ਕਿਉਂਕਿ ਹਰ ਕੋਈ ਛੋਟੀ ਨੌਕਰੀ ਨਹੀਂ ਕਰਨਾ ਚਾਹੁੰਦਾ ਬਸ ਸਭ ਇੱਕ ਨੂੰ ਵੱਡੇ ਵੱਡੇ ਅਹੁਦੇ ਚਾਹੀਦੇ ਹਨ ਅੱਜ ਕੱਲ੍ਹ ਬਹੁਤ ਸਾਰੀਆਂ ਫੈਕਟਰੀਆਂ ਲੱਗ ਗਈ ਰਹੀਆਂ ਹਨ ਜਿਸ ਵਿੱਚ ਬਹੁਤੇ ਸਾਰੇ ਲੋਕਾਂ ਨੂੰ ਰੋਜ਼ੀ ਰੋਟੀ ਮਿਲ ਰਹੀ ਹੈ